ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਨੂੰ ਪ੍ਰਾਪਤ ਕਰਨ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਕਿਉਂਕਿ ਮੈਂ ਇੱਕ ਪਿੰਡ ਦੀ ਵਸਨੀਕ ਹਾਂ ਅਤੇ ਮੇਰਾ ਪਿੰਡ ਵੀ ਇੱਕ ਪਛੜੇ ਹੋਏ ਸ਼ਹਿਰ ਦੇ ਵਿੱਚ ਹੈ ਜਿਹੜਾ ਕਿ ਮਾਨਸਾ ਸ਼ਹਿਰ ਦੇ ਵਿੱਚ ਪੈਂਦਾ ਹੈ ਮਾਨਸਾ ਬਹੁਤ ਹੀ ਪਛੜਿਆ ਹੋਇਆ ਸ਼ਹਿਰ ਹੈ ਅਤੇ ਉਸਦੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਸਹੂਲਤਾਂ ਦੀ ਕਮੀ ਹੈ ਮੇਰੇ ਪਿੰਡ ਦੇ ਵਿੱਚ ਸਿਰਫ ਅੱਠਵੀਂ ਤੱਕ ਦਾ ਹੀ ਸਕੂਲ ਸੀ ਅਤੇ ਹਾਇਰ ਐਜੂਕੇਸ਼ਨ ਦੇ ਲਈ ਮੈਨੂੰ ਸ਼ਹਿਰ ਜਾਣਾ ਪੈਣਾ ਸੀ ਅਤੇ ਇਸ ਤੋਂ ਬਾਅਦ ਅੱਠਵੀਂ ਤੋਂ ਬਾਅਦ ਜਦੋਂ ਮੈਂ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਲਿਆ ਤਾਂ ਉਸਦੇ ਲਈ ਮੈਨੂੰ ਆਉਣ ਜਾਣ ਦੇ ਲਈ ਟ੍ਰਾਂਸਪੋਰਟ ਦੀ ਕੋਈ ਵੀ ਸਹੂਲਤ ਨਹੀਂ ਸੀ ਮੈਨੂੰ ਦੋ ਦੋ ਘੰਟੇ ਬਸ ਸਟੈਂਡ 'ਤੇ ਹੀ ਇੰਤਜ਼ਾਰ ਕਰਨਾ ਪੈਂਦਾ ਸੀ ਕਿਉਂਕਿ ਪਿੰਡਾਂ ਨੂੰ ਬੱਸਾਂ ਕਾਫੀ ਟਾਈਮ ਬਾਅਦ ਜਾਂਦੀਆਂ ਨੇ ਘੰਟੇ ਜਾਂ ਡੇਢ ਘੰਟੇ ਬਾਅਦ ਮੇਰੇ ਪਿੰਡ ਦੇ ਵਿੱਚ ਟ੍ਰੇਨ ਦੀ ਸਹੂਲਤ ਹੈ ਸੀ ਪਰ ਟ੍ਰੇਨ ਇੱਕ ਘੰਟਾ ਦੋ ਘੰਟੇ ਲੇਟ ਆਉਂਦੀ ਸੀ ਜਿਸ ਦੇ ਨਾਲ ਮੇਰਾ ਕਾਫੀ ਟਾਈਮ ਬੱਸਾਂ ਦੇ ਵਿੱਚ ਹੀ ਵੇਸਟ ਹੋ ਜਾਂਦਾ ਸੀ ਅਤੇ ਮੈਂ ਆਪਣੀ ਪੜ੍ਹਾਈ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦੀ ਸੀ ਉਸ ਤੋਂ ਇਲਾਵਾ ਨੇੜੇ ਤੇੜੇ ਮੇਰੇ ਪਿੰਡ ਦੇ ਕੋਈ ਵੀ ਚੰਗਾ ਕੋਲਜ ਨਹੀਂ ਸੀ ਉਸ ਟਾਈਮ 'ਤੇ ਅਤੇ ਫਿਰ ਮੈਂ ਆਪਣੀ ਹਾਇਰ ਐਜੂਕੇਸ਼ਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਮੇਰੀ ਲੈਂਗੁਏਜ ਪੰਜਾਬੀ ਹੋਣ ਕਰਕੇ ਮੈਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿਉਂਕਿ ਹਾਇਰ ਐਜੂਕੇਸ਼ਨ ਦੇ ਵਿੱਚ ਜੋ ਮੈਨੂੰ ਮਟੀਰੀਅਲ ਮਿਲਣਾ ਸੀ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲਣਾ ਸੀਗਾ ਮੈਂ ਆਪਣੀ ਜਿਹੜੀ ਹਾਇਰ ਐਜੂਕੇਸ਼ਨ ਇਕਨੋਮਿਕਸ ਦੇ ਵਿੱਚ ਕੀਤੀ ਅਤੇ ਮੈਂ ਉਸ ਟਾਈਮ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਦੂਸਰਾ ਮੈਨੂੰ ਉਸ ਟਾਈਮ 'ਤੇ ਹੋਸਟਲ ਦੇ ਵਿੱਚ ਰਹਿਣਾ ਪੈਣਾ ਸੀ ਅਤੇ ਹੋਸਟਲ ਦੇ ਵਿੱਚ ਜਿਹੜੀ ਖਾਣੇ ਦੀ ਕੁਆਲਿਟੀ ਸੀ ਉਸ ਟਾਈਮ ਵਧੀਆ ਨਹੀਂ ਸੀਗੀ ਓਨੀ ਜ਼ਿਆਦਾ ਵਧੀਆ ਨਹੀਂ ਸੀ ਜਿੰਨੀ ਕਿ ਸਾਨੂੰ ਘਰ ਦੇ ਵਿੱਚ ਵਧੀਆ ਖਾਣਾ ਮਿਲਦਾ ਗਾ ਅਤੇ ਫਾਨੈਂਸ਼ਅਲੀ ਤੌਰ 'ਤੇ ਵੀ ਫਿਰ ਅਸੀਂ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਦੇ ਹਾਂ ਕਿਉਂਕਿ ਕੋਈ ਵੀ ਸਕੋਲਰਸ਼ਿਪ ਜਾਂ ਇੱਦਾਂ ਦੀ ਸਾਨੂੰ ਨਹੀਂ ਦਿੱਤੀ ਗਈ ਸੀਗੀ ਅਤੇ ਅਸੀਂ ਘਰੋਂ ਹੀ ਪੈਸੇ ਮੰਗਵਾਉਂਦੇ ਸੀਗੇ ਅਤੇ ਜਿਸ ਦੇ ਕਾਰਨ ਅਸੀਂ ਆਪਣੀ ਐਜੂਕੇਸ਼ਨ ਦੇ ਦੌਰਾਨ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ